ਪਿੰਡਾਂ ਵਿੱਚ ਬਿਜਲੀ ਦੀ ਸਮੱਸਿਆ ਅਜੇ ਵੀ ਬਹੁਤ ਆ ਰਹੀ ਹੈ ਕਈ ਪਿੰਡਾਂ ਵਿੱਚ ਹਲੇ ਵੀ ਬਿਜਲੀ ਪਹੁੰਚੀ ਤੱਕ ਨਹੀਂ ਹੈਗੀ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਦੇਣੀ ਚਾਹੀਦੀ ਹੈ ਬਿਜਲੀ ਦੇ ਥਾਂ ਥਾਂ 'ਤੇ ਖੰਭੇ ਲਗਵਾਉਣੇ ਚਾਹੀਦੇ ਹੈ ਅਤੇ ਬਿਜਲੀ ਦੀਆਂ ਤਾਰਾਂ ਘਰਾਂ ਘਰਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਗਰੀਬ ਹਲਕੇ ਦੇ ਲੋਕ ਵੀ ਹੈ ਉਹ ਵੀ ਥੋੜ੍ਹਾ ਜਿਹਾ ਸੁੱਖ ਦਾ ਸਾਹ ਲੈ ਸਕਣ ਅਤੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਵੀ ਲਗਵਾਉਣੀਆਂ ਚਾਹੀਦੀਆਂ ਜਿਹਦੇ ਵਿੱਚ ਹਨੇਰੇ 'ਚ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਹਦਾ ਪਤਾ ਲੱਗ ਸਕੇ ਅਤੇ ਜਿਹੜੀ ਖੇਤੀ ਹੈ ਉਹ ਤਾਂ ਪੂਰੀ ਦੀ ਪੂਰੀ ਬਿਜਲੀ 'ਤੇ ਹੀ ਨਿਰਭਰ ਹੈ ਕਿਉਂਕਿ ਜਿਹੜੀਆਂ ਖੇਤਾਂ ਨੂੰ ਪਾਣੀ ਦੇਣ ਲਈ ਮੋਟਰਾਂ ਚਾਹੀਦੀਆਂ ਮੋਟਰਾਂ ਲੱਗਦੀਆਂ ਟਿਊਬਵੈੱਲ ਅਤੇ ਉਹ ਬਿਜਲੀ 'ਤੇ ਹੀ ਨਿਰਭਰ ਹੈ ਜ਼ਿਆਦਾਤਰ ਬਿਜਲੀ ਹੋਣ ਦੇ ਨਾਲ ਹੀ ਖੇਤਾਂ ਦੀ ਉਹ ਸਿੰਚਾਈ ਕਰ ਸਕਦੇ ਹੈ ਅਤੇ ਜੇਕਰ ਪਿੰਡਾਂ ਵਿੱਚ ਬਿਜਲੀ ਦੀ ਸ਼ੋਰਟੇਜ ਰਹੇਗੀ ਬਿਜਲੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ ਤਾਂ ਉਨ੍ਹਾਂ ਨੂੰ ਖੇਤੀ ਦੀ ਸਿੰਚਾਈ ਕਰਨ ਵਿੱਚ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜਿਹੜਾ ਕਿ ਕਰਨਾ ਹੀ ਪੈ ਰਿਹਾ ਅਤੇ ਕਈ ਅੱਜ ਵੀ ਪੁਰਾਣੇ ਇੰਜਣਾਂ ਦੇ ਨਾਲ ਟਿਊਬਵੈੱਲ ਚਲਾ ਰਹੇ ਨੇ ਅਤੇ ਉਨ੍ਹਾਂ ਨੂੰ ਉਨ੍ਹਾਂ ਨੂੰ ਉਹਦੇ ਨਾਲ ਬਹੁਤ ਡੀਜ਼ਲ ਵੀ ਫੁਕ ਰਿਹਾ ਹੈ ਅਤੇ ਉਨ੍ਹਾਂ ਨੂੰ ਖੇਤੀ ਮਹਿੰਗੀ ਵੀ ਬਹੁਤ ਪੈ ਰਹੀ ਹੈ ਬਿਜਲੀ ਹੋਣ ਦੇ ਨਾਲ ਟਿਊਬਵੈੱਲਾਂ ਲੁਆ ਕੇ ਉਹ ਸੌਖੇ ਤਰੀਕੇ ਨਾਲ ਅਤੇ ਸਸਤੀ ਖੇਤੀ ਵੀ ਥੋੜ੍ਹੀ ਜਿਹੀ ਕਰ ਸਕਦੇ ਹੈ ਅਤੇ ਜਿਹਦੇ ਨਾਲ ਉਨ੍ਹਾਂ ਨੂੰ ਥੋੜ੍ਹਾ ਜਿਹਾ ਆਰਾਮ ਵੀ ਮਿਲੇਗਾ